ਮੈਂ ਜ਼ਿਆਦਾਤਰ ਕੀਰਤਨ ਅਤੇ ਵਿਆਹ ਸ਼ਾਦੀਆਂ ਦੇ ਮਾਹੌਲ ਦੇ ਵਿੱਚ ਗਾਣਾ ਪਸੰਦ ਕਰਦੇ ਹਾਂ ਵਰਨਾ ਘਰ ਵਿੱਚ ਗੁਣਗੁਣਾਉਣਾ ਪਸੰਦ ਕਰਦੇ ਹਾਂ